ਨਮ ਨਵ ਜੰਮੇ ਬੱਚੇ ਦੇ ਜਨਮ ਤੋਂ ਲੈ ਕੇ ਪਹਿਲੇ ਸਾਲ ਤੱਕ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਬੱਚੇ ਦੇ ਸ ਜਨਮ ਤੋਂ ਬਾਅਦ ਉਸ ਨੂੰ ਗੁੜਤੀ ਦੀ ਰਸਮ ਕੀਤੀ ਜਾਂਦੀ ਹੈ ਜਿਸ ਵਿੱਚ ਬੱਚੇ ਨੂੰ ਉਸਦੇ ਘਰ ਦੇ ਮੈਂਬਰਾਂ ਵਿੱਚੋਂ ਕੋਈ ਇੱਕ ਜਣਾ ਇਹ ਗੁੜਤੀ ਦੀ ਰਸਮ ਕਰਦਾ ਹੈ ਇਸ ਨਾਲ ਸ਼ਹਿਦ ਚਟਾਇਆ ਜਾਂਦਾ ਹੈ ਇਸ ਤੋਂ ਬਾਅਦ ਬੱਚੇ ਦਾ ਤੇਰਵਾਂ ਕੀਤਾ ਜਾਂਦਾ ਘਰ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੇ ਦੇ ਖੁਸ਼ੀ ਕੀਤੀ ਜਾਂਦੀ ਹੈ ਉਸ ਦਿਨ ਆਪਣੇ ਵੱਡਿਆਂ ਨੂੰ ਰੋਟੀ ਖਵਾਈ ਜਾਂਦੀ ਹੈ ਇਸ ਤੋਂ ਬਾਅਦ ਬੱਚੇ ਦੇ ਬੱਚੇ ਦੇ ਜੇਕਰ ਬੱਚੇ ਦਾ ਜਨਮ ਦਾਦੀ ਪਰਿਵਾਰ ਵਿੱਚ ਹੋਇਆ ਹੋਵੇ ਤਾਂ ਨਾਨਕਾ ਪਰਿਵਾਰ ਉਸ ਲਈ ਜੰਮਣੀ ਲੈ ਕੇ ਆਉਂਦਾ ਹੈ ਜਿਸ ਵਿੱਚ ਬੱਚੇ ਲਈ ਬਹੁਤ ਸਾਰਾ ਸਮਾਨ ਅਤੇ ਉਸਦੀ ਮਾਤਾ ਲਈ ਲਿਆਉਂਦਾ ਜਾਂਦਾ ਹੈ ਇਹ ਵੀ ਇੱਕ ਤਰ੍ਹਾਂ ਦੀ ਰਸਮ ਹੀ ਹੈ ਬਾਕੀ ਹਰੇਕ ਧਰਮ ਵਿੱਚ ਆਪਣੀ ਵੱਖਰੀ ਵੱਖਰੀ ਰਸਮ ਹੁੰਦੀ ਹੈ ਜਿਸ ਤਰਾਂ ਹਿੰਦੂ ਪਰਿਵਾਰ ਵਿੱਚ ਬੱਚੇ ਦੀ ਮੁੰ ਮੁੰਡਨ ਦੀ ਰਸਮ ਕੀਤੀ ਜਾਂਦੀ ਹੈ ਇਸ ਤੋਂ ਇਸ ਤੋਂ ਬਾਅਦ ਬੱਚੇ ਦਾ ਸਵਾ ਮਹੀਨੇ ਬਾਅਦ ਬੱਚੇ ਦਾ ਜਨਮ ਨਾਮਕਰਨ ਕੀਤਾ ਜਾਂਦਾ ਹੈ ਸਿੱਖ ਪਰਿਵਾਰ ਵਿੱਚ ਇਹ ਰਸਮ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਬੱਚੇ ਦੇ ਬਹੁਤ ਸਾਰੇ